ਹਾਂਜੀ ਔਰਤਾਂ ਦੇ ਮੁੱਦਿਆਂ ਨੂੰ ਸਮਰਪਿਤ ਪ੍ਰੋਗਰਾਮ ਜੋ ਔਰਤਾਂ ਦਾ ਵਿਸ਼ੇਸ਼ ਦਿਨ ਹੈਗਾ ਅੱਠ ਮਾਰਚ ਉਹ ਹੁੰਦਾ ਹੈਗਾ ਉਹਦੇ ਵਿੱਚ ਕੀ ਆ ਔਰਤਾਂ ਦੇ ਮੁੱਦਿਆਂ 'ਤੇ ਗੱਲ ਹੁੰਦੀ ਆ ਉਹ ਮੈਗਜ਼ੀਨ ਦੇ ਵਿੱਚ ਔਰਤਾਂ ਦੇ ਵਿਚਾਰ ਪੇਸ਼ ਕੀਤੇ ਜਾਂਦੇ ਨੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਇਆ ਜਾਂਦਾ ਸਾਡੇ ਵਿੱਚ ਸਕੂਲ ਦੇ ਵਿੱਚ ਜੋ ਕਿ ਪ੍ਰੋਗਰਾਮ ਹੋਇਆ ਸੀ ਔਰਤਾਂ ਦੇ ਵਿਸ਼ੇ ਨੂੰ ਲੈ ਕੇ ਨਾਰੀ ਸ਼ਕਤੀ ਕਿਉਂਕਿ ਜਿਹੜੇ ਅਜੋਕੀ ਨਾਰੀ ਹੈ ਬਹੁਤ ਹੀ ਸ਼ਕਤੀਸ਼ਾਲੀ ਹੈ ਪੇਪਰਾਂ ਦੇ ਵਿੱਚ ਜਾਂ ਰੇਡੂ ਪੇਪਰ ਦੇ ਵਿੱਚ ਜਾਂ ਰੇਡੀਓ ਦੇ ਵਿੱਚ ਘਰੇਲੂ ਔਰਤਾਂ ਲਈ ਵਿਸ਼ੇਸ਼ ਸੈਕਸ਼ਨ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਕੀ ਹੈ ਜੋ ਘਰੇਲੂ ਔਰਤਾਂ ਨੇ ਉਹਨਾਂ ਨੂੰ ਐ ਨਹੀਂ ਸੁਣ ਐਂ ਨਾ ਫੀਲ ਹੋਵੇ ਵੀ ਹਾਂ ਅਸੀਂ ਕਿਸੇ ਨਾਲੋਂ ਘੱਟ ਹੈ ਅਸੀਂ ਘਰ ਦੇ ਵਿੱਚ ਰਹਿੰਦੇ ਹਾਂ ਵੀ ਹਾਂ ਸਾਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਦੇ ਨਾਲ ਰਿਲੇਟਡ ਕੋਈ ਨਾ ਕੋਈ ਪ੍ਰੋਗਰਾਮ ਹੋਣਾ ਚਾਹੀਦਾ ਹੈ ਤਾਂ ਕਿ ਜੋ ਉਹ ਘਰੇਲੂ ਔਰਤਾਂ ਨੇ ਉਹ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਾ ਸਮਝਣ ਔਰਤਾਂ ਦੇ ਸਮਰਪਿਤ ਪ੍ਰੋਗਰਾਮ ਦੇ ਵਿੱਚ ਔਰਤਾਂ ਦੀਆਂ ਜੋ ਕਿ ਘਰੇਲੂ ਸਮੱਸਿਆਵਾਂ ਨੇ ਉਹਨਾਂ ਨੂੰ ਨਜਿੱਠਣ ਦੇ ਤਰੀਕੇ ਵੀ ਜ਼ ਦੱਸਣੇ ਚਾਹੀਦੇ ਨੇ ਤਾਂ ਜੋ ਉਹ ਆਪਣੇ ਘਰ ਬੈਠੇ ਅਗਰ ਉਹ ਕਿਸੇ ਨਾਲ ਆਪਣੀ ਸਮੱਸਿਆ ਸ ਸਾਂਝੀ ਸਾਂਝੀ ਨਹੀਂ ਕਰ ਸਕਦੀਆਂ ਤਾਂ ਉਹਨਾਂ ਨੂੰ ਇਸ ਪ੍ਰੋਗਰਾਮ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਤਾਂ ਕਿ ਉਹ ਸਿੱਖ ਕੇ ਉਹ ਆਪਣੇ ਆਪ 'ਤੇ ਅਪਲਾਈ ਕਰਨ ਕਈ ਵਾਰ ਹੁੰਦੀਆਂ ਨੇ ਔਰਤਾਂ ਜੋ ਆਪਣੇ ਘਰੇਲੂ ਸਮੱਸਿਆਵਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਦੀਆਂ ਈਵਨ ਕਿ ਆਪਣੇ ਪਤੀ ਨਾਲ ਵੀ ਸਾਂਝਾ ਨਹੀਂ ਕਰਦੀਆਂ ਤਾਂ ਅਜਿਹੀਆਂ ਔਰਤਾਂ ਦੇ ਲਈ ਘਰੇਲੂ ਪ੍ਰੋਗਰਾਮ ਜ਼ਰੂਰੀ ਹਨ